ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਵੀ ਜਿਹੜੇ ਪੰਜਾਬ 'ਚ ਹੈ ਉਹ ਇੱਥੇ ਦਾ ਐਜੂਕੇਸ਼ਨ ਸਿਸਟਮ ਜਿਹੜਾ ਸਿੱਖਿਆ ਦਾ ਪੱਧਰ ਹੈ ਉਹਨੂੰ ਉੱਚਾ ਚੱਕਣ ਵਾਸਤੇ ਬਹੁਤ ਸਾਰੀਆਂ ਸਕੀਮਾਂ ਚਲਾਈਆਂ ਗਈਆਂ ਹਨ ਜਿਵੇਂ ਕਿ ਆਪਾ ਪਿੱਛੇ ਬੈਗ੍ਰਾਉਂਡ 'ਚ ਦੇਖਿਆ ਜਾਵੇ ਪਿੱਛੇ ਚੱਲ ਕੇ ਦੇਖਿਆ ਜਾਵੇ ਤਾਂ ਜਿਹੜੇ ਉੱਥੇ ਦੇ ਪੰਜਾਬ ਦੀ ਜਿਹੜੀਆਂ ਬੱਚੀਆਂ ਹੁੰਦੀਆਂ ਸੀਗੀਆਂ ਜਿਹੜੀਆਂ ਪਿੰਡਾਂ ਤੋਂ ਸ਼ਹਿਰਾਂ 'ਚ ਜਾਂ ਆਪਣੇ ਤੋਂ ਦੂਰ ਦੇ ਇਲਾਕੇ ਜਿਹੜੇ ਪੈਂਦੇ ਸਕੂਲ ਆ ਉੱਥੇ ਜਾਣਾ ਪੈਂਦਾ ਤਾ ਉਹਨਾਂ ਨੂੰ ਤਾਂ ਉਹਨਾਂ ਵਾਸਤੇ ਜਿਹੜੀ ਹੈਗੀ ਹੈ ਸਰਕਾਰ ਨੇ ਮਾਈ ਭਾਗੋ ਸਕੀਮ ਚਲਾਈ ਸੀਗੀ ਮਾਈ ਭਾਗੋ ਸਕੀਮ ਹੈ ਕਿਆ ਤੀ ਉਹਦੇ ਵਿੱਚ ਹੁੰਦਾ ਤਾ ਜਿਹੜੇ ਉੱਥੇ ਦੇ ਬੱਚੀਆਂ ਹੁੰਦੀਆਂ ਤੀਆ ਜਿਹੜੀਆਂ ਉੱਥੇ ਦੇ ਦੂਰ ਦੇ ਇਲਾਕੇ ਦੀਆਂ ਪਿੰਡਾਂ ਦੀਆਂ ਬੱਚੀਆਂ ਹੁੰਦੀਆਂ ਤੀਆਂ ਉਹਨਾਂ ਨੂੰ ਸਕੂਲ ਤੱਕ ਆਉਣ ਵਾਸਤੇ ਉਹਨਾਂ ਨੂੰ ਸਾਈਕਲ ਪ੍ਰੋਵਾਈਡ ਕੀਤੇ ਜਾਂਦੇ ਸੀਗੇ ਸਾਈਕਲ ਦਿੱਤੇ ਜਾਂਦੇ ਸੀਗੇ ਅਤੇ ਨੰਬਰ ਦੋ 'ਤੇ ਜਿੱਦਾਂ ਹੁਣ ਕੋਈ ਬੱਚਾ ਕਾਲਜ 'ਚ ਪੜ੍ਹਦਾ ਹੈਗਾ ਏ ਤਾਂ ਘੱਟ ਗਿਣਤੀ ਵਾਲਿਆਂ ਵਾਸਤੇ ਤਾਂ ਘੱਟ ਗਿਣਤੀ ਵਾਸਤੇ ਉਹਨਾ ਨੂੰ ਵਜੀਫ਼ਾ ਦਿੱਤਾ ਜਾਂਦਾ ਸੀਗਾ ਅਤੇ ਨੰਬਰ ਦੋ 'ਤੇ ਉਹਨੂੰ ਕੈਟੇਗਿਰੀ ਜਾਂ ਉਹਨੂੰ ਕਾਸਟ ਜਾਂ ਫਿਰ ਜਾਤ ਦੇ ਆਧਾਰ 'ਤੇ ਉਹਨੂੰ ਉੱਥੇ ਓਹ ਵੀ ਵਜੀਫ਼ਾ ਦਿੱਤਾ ਜਾਂਦਾ ਤਾ ਅਤੇ ਓਹਦੇ ਖਰਚੇ ਵਿੱਚ ਜਾਂ ਫਿਰ ਜਿਹੜੀਆਂ ਉਹਦੀਆਂ ਉੱਥੇ ਜਿਹੜਾ ਉਹਦਾ ਕਿਆ ਕਹਿ ਸਕਦੇ ਹਾਂ ਉਹਨੂੰ ਆਪਾਂ ਜਿੱਦਾਂ ਉਹਦੇ ਵਿੱਚ ਖਰਚਾ ਜਾਂ ਫੀਸ ਵਿੱਚ ਉਹਨੂੰ ਕਾਫੀ ਤਰ੍ਹਾਂ ਦੀ ਰਿਆਇਤ ਦਿੱਤੀ ਜਾਂਦੀ ਸੀਗੀ